ਹੈਲੋ ਸਰ ਸਤਿ ਸ਼੍ਰੀ ਅਕਾਲ ਤੁਸੀਂ ਸਵੀਗੀ ਤੋਂ ਬੋਲਦੇ ਹੋ ਮੈਂ ਗੁਰਪ੍ਰੀਤ ਸਿੰਘ ਪਟਿਆਲੇ ਤੋਂ ਬੋਲ ਰਿਹਾ ਤੁਹਾਡਾ ਡੇਲੀ ਦਾ ਕਸਟਮਰ ਸਰ ਮੈਂ ਤੁਹਾਡੇ ਤੋਂ ਦੋ ਚਪਾਤੀਆਂ ਔਡਰ ਕੀਤੀਆਂ ਹਾ ਸੀ ਤੁਹਾਡਾ ਖਾਣਾ ਬਹੁਤ ਵਧੀਆ ਹੁੰਦਾ ਹੈ ਅਸੀਂ ਤੁਹਾਡੇ ਤੋਂ ਹੀ ਔਡਰ ਕਰਦੇ ਹਾਂ ਤੁਹਾਡਾ ਖਾਣਾ ਬਹੁਤ ਵਧੀਆ ਅਤੇ ਤਾਜ਼ਾ ਹੁੰਦਾ ਹੈ ਤੁਹਾਡਾ ਖਾਣਾ ਸਾਡੇ ਕੋਲ ਸਹੀ ਟਾਈਮ 'ਤੇ ਪਹੁੰਚ ਜਾਂਦਾ ਹੈ ਅਤੇ ਜਿਹੜੀਆਂ ਅਸੀਂ ਦੋ ਚਪਾਤੀਆਂ ਮੰਗਵਾਈਆਂ ਸੀ ਉਸ ਵਿੱਚੋਂ ਇੱਕ ਹੀ ਮੰਗਵਾਉਣਾ ਚਾਹੁੰਦੇ ਹਾਂ ਇੱਕ ਤੁਸੀਂ ਕੈਂਸਲ ਕਰ ਦਿਓ ਧੰਨਵਾਦ